ਮੈਂ ਗੁਰਦਾਸਪੁਰ ਰਾਜਕੁਮਾਰ ਗੁਰਦਾਸਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਮੈਂ ਇੱਕ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹਾਂ ਅਚਾਨਕ ਇੱਕ ਦਿਨ ਮੈਂ ਘਰ ਵਿੱਚ ਬੈਠਾ ਸੀ ਤਾਂ ਮੇਰਾ ਮਕਾਨ ਮਾਲਕ ਆ ਗਿਆ ਉਹ ਕਹਿੰਦਾ ਕਿ ਤੁਸੀਂ ਪਾਣੀ ਦਾ ਛੇ ਮਹੀਨੇ ਤੋਂ ਬਿਲ ਨਹੀਂ ਤਾਰਿਆ ਮੈਂ ਉਸ ਨਾਲ ਬਹਿਸ ਕਰਦਾ ਹਾਂ ਕਿ ਮੈਂ ਪਾਣੀ ਦਾ ਬਿਲ ਹਰ ਮਹੀਨੇ ਟਾਈਮ ਟਾਈਮ 'ਤੇ ਤਾਰਿਆ ਹੋਇਆ ਹੈ ਮਕਾਨ ਮਾਲਕ ਕਹਿੰਦਾ ਕਿ ਉਸ ਦਾ ਮੈਨੂੰ ਰਸੀਦ ਜਾਂ ਪਰੂਫ ਕਰਵਾਓ ਕਿ ਤੁਸੀਂ ਛੇ ਮਹੀਨੇ ਦਾ ਪਾਣੀ ਦਾ ਬਿੱਲ ਤਾਰਿਆ ਹੋਇਆ ਹੈ ਮੈਂ ਮਕਾਨ ਮਾਲਕ ਨੂੰ ਕਿਹਾ ਕਿ ਮੈਂ ਦੁਬਾਰਾ ਜਲ ਵਿਭਾਗ ਜਾ ਕੇ ਕਰਦਾ ਹਾਂ ਅਪਲਾਈ ਕਰਦਾ ਹਾਂ ਕਿ ਮੈਨੂੰ ਛੇ ਮਹੀਨੇ ਦਾ ਜਿਹੜਾ ਮੇਰਾ ਪਾਣੀ ਦਾ ਬਿਲ ਹੈ ਉਹਦਾ ਰਿਕਾਰਟ ਦਿੱਤਾ ਜਾਵੇ ਤਾਂ ਕਿ ਮੈਂ ਆਪਣੇ ਮਾਲਕ ਨੂੰ ਵਿਖਾ ਕੇ ਇਹ ਸਾਬਿਤ ਕਰ ਸਕਾਂ ਕਿ ਮੈਂ ਪਾਣੀ ਦਾ ਬਿੱਲ ਸਮੇਂ ਸਿਰ ਦਿੰਦਾ ਸੀ ਤਾਂ ਮੇਰਾ ਮਾਲਕ ਉਸ 'ਤੇ ਯਕੀਨ ਕਰੇਗਾ ਮੈਂ ਜਲ ਵਿਭਾਗ ਨੂੰ ਦੁਬਾਰਾ ਫੋਨ ਕੀਤਾ ਕਿ ਸਰ ਮੇਰਾ ਪਿਛਲੇ ਛੇ ਮਹੀਨੇ ਦਾ ਪਾਣੀ ਦੇ ਬਿਲ ਦਾ ਰਿਕਾਰਟ ਮੈਨੂੰ ਕੱਢ ਕੇ ਦਿੱਤਾ ਜਾਵੇ ਤਾਂ ਕਿ ਮੈਂ ਆਪਣੇ ਮਾਲਕ ਨੂੰ ਮੇਰਾ ਮਾਲਕ ਕਹਿ ਰਿਹਾ ਹੈ ਕਿ ਤੁਸੀਂ ਛੇ ਮਹੀਨੇ ਦਾ ਪਾਣੀ ਦਾ ਬਿੱਲ ਨਹੀਂ ਦਿੱਤਾ ਤਾਂ ਜੋ ਮੈਂ ਉਹ ਦਿਖਾ ਕੇ ਆਪਣੇ ਮਾਲਕ ਨੂੰ ਦੱਸ ਸਕਾਂ ਕਿ ਮੈਂ ਇਹ ਪਾਣੀ ਦਾ ਬਿੱਲ ਟਾਈਮ ਸਿਰ ਦਿੱਤਾ ਗਿਆ ਹੈ ਫਿਰ ਪੰਦਰਾਂ ਦਿਨਾਂ ਬਾਅਦ ਪਾ ਜਲ ਵਿਭਾਗ ਤੋਂ ਮੈਨੂੰ ਉਹਨਾਂ ਨੇ ਮੇਰੇ ਛੇ ਮਹੀਨੇ ਪਾਣੀ ਦੇ ਬਿਲ ਦਾ ਰਿਕਾਰਟ ਕੱਢ ਕੇ ਦਿੱਤਾ ਉਹ ਮੈਂ ਆਪਣੇ ਮਾਲਕ ਨੂੰ ਵਿਖਾਇਆ ਤਾਂ ਉਸਨੂੰ ਯਕੀਨ ਹੋ ਗਿਆ ਕਿ ਛੇ ਮਹੀਨੇ ਦਾ ਪਾਣੀ ਦਾ ਬਿੱਲ ਤੁਸੀਂ ਤਾਰਿਆ ਹੋਇਆ ਹੈ